ਸਿੱਖਿਆ ਪ੍ਰਣਾਲੀ ਉਹਨਾਂ ਵਿਦਿਆਰਥੀਆਂ ਲਈ ਜੋ ਕਿ ਅੰਨ੍ਹੇ ਹਨ ਬੋਲੇ ਹਨ ਜਾਂ ਕਹਿ ਸਕਦੇ ਹਾਂ ਅਪਾਹਜ ਹਨ ਜਾਂ ਫਿਰ ਮੰਦਬੁੱਧੀ ਹਨ ਬਹੁਤ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਜਿਵੇਂ ਉਹਨਾਂ ਦੇ ਲਈ ਡੇ ਬੋਰਡਿੰਗ ਸਕੂਲ ਖੋਲ੍ਹੇ ਗਏ ਹਨ ਜਿੱਥੇ ਉਹ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਨਿਖ਼ਾਰ ਰਹੇ ਹਨ ਕਿਉਂਕਿ ਉੱਥੇ ਉਹਨਾਂ ਦੇ ਅਧਿਆਪਕਾਂ ਵੱਲੋਂ ਉਹਨਾਂ ਨੂੰ ਬਹੁਤ ਸਾਰੀਆਂ ਸਕਿੱਲਸ ਸਿਖਾਈਆਂ ਜਾਂਦੀਆਂ ਨੇ ਪੜ੍ਹਾਈ ਦੇ ਨਾਲ ਨਾਲ ਜਿਵੇਂ ਮੋਮਬੱਤੀਆਂ ਬਣਾਉਣਾ ਕਾਰਡ ਬਣਾਉਣਾ ਇਸ ਤਰੀਕੇ ਨਾਲ ਉਹ ਇੱਕ ਆਪਣੇ ਆਪ ਵਿਚ ਆਤਮ ਇਸ਼ ਵਿਸ਼ਵਾਸ ਲੈ ਕੇ ਆਉਂਦੇ ਹਨ ਕਿ ਅਸੀਂ ਵੀ ਆਤਮ ਨਿਰਭਰ ਹੋ ਸਕਦੇ ਹਾਂ ਹੋਰਾਂ ਵਾਂਗ ਸਾਡੇ ਵਿੱਚ ਵੀ ਕੁਝ ਅਜਿਹੇ ਜੋ ਹੈਗੇ ਨੇ ਵੀ ਯੋਗਤਾਵਾਂ ਹੈਗੀਆਂ ਨੇ ਕਿ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਅੱਗੇ ਇੱਕ ਵਧੀਆ ਨਾਗਰਿਕ ਦੇ ਰੂਪ ਵਿੱਚ ਪੇਸ਼ ਕਰ ਸਕਦੇ ਹਨ ਅ ਸਾਡੇ ਵਿੱਚ ਵੀ ਉਹ ਯੋਗਤਾ ਹੈ ਜੋ ਦੂਸਰੇ ਵਿਦਿਆਰਥੀਆਂ ਵਿੱਚ ਹੁੰਦੀ ਹੈ ਅਤੇ ਉਹ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ ਉਹਨਾਂ ਲਈ ਬਹੁਤ ਸਾਰੇ ਅਜਿਹੇ ਸਮਾਗਮ ਰੱਖੇ ਜਾਂਦੇ ਹਨ ਉਹਨਾਂ ਲਈ ਬਹੁਤ ਸਾਰੇ ਕੰਪੀਟੀਟਿਵ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਉਹ ਵੱਧ ਚੜ ਕੇ ਹਿੱਸਾ ਲੈ ਸਕਣ ਅਤੇ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣ ਡੇ ਬੋਰਡਿੰਗ ਸਕੂਲਾਂ ਦੇ ਵਿੱਚ ਉਹਨਾਂ ਨੂੰ ਅ ਸਕੂਲਾਂ ਦੇ ਵਿੱਚ ਖਾਣਾ ਵੀ ਆਪ ਮੁਹਈਆ ਕਰਵਾਇਆ ਜਾਂਦਾ ਹੈ ਅਤੇ ਅਧਿਆਪਕ ਜਾਂ ਉਹ ਸੰਸਥਾ ਖੁਦ ਜਿੰਮੇਵਾਰੀ ਚੁੱਕਦੀ ਹੈ ਕਿ ਅਸੀਂ ਤੁਹਾਡੇ ਬੱਚੇ ਨੂੰ ਪਾਲ ਪੋਸ਼ ਕੇ ਅਤੇ ਉਹਨਾਂ ਨੂੰ ਇੱਕ ਵਧੀਆ ਸ਼ਖਸੀਅਤ ਦੇ ਰੂਪ ਵਿੱਚ ਤੁਹਾਡੇ ਕੋਲ ਬਣਾ ਕੇ ਪੇਸ਼ ਕਰਾਂਗੇ ਸ਼ਖਸੀਅਤ ਤੇ ਉਹ ਇਸ ਦਾ ਕੋਈ ਵੀ ਜੋ ਜਿੰਮਾ ਜਿੰਮੇਵਾਰੀ ਬਾਰੇ ਨਾ ਸੋਚਣ ਕਿ ਕਿਵੇਂ ਹੋਵੇਗਾ ਉਹ ਖੁਦ ਆਪਣੇ ਆਪ ਵਿੱਚ ਇੰਨੇ ਕਾਬਲ ਬਣਾ ਦਿੰਦੇ ਹਨ ਕਿ ਬੱਚੇ ਆਪਣੇ ਆਪ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਾਜ ਦੇ ਵਿੱਚ ਪੇਸ਼ ਕਰਦੇ ਹਨ ਅਤੇ ਜੇ ਆਪਾਂ ਗੱਲ ਕਰੀਏ ਕੋਲਜਾਂ ਦੀ ਜਾਂ ਸਾਰੇ ਸਕੂਲਾਂ ਦੀ ਹੀ ਸਾਰੇ ਕਿਤੇ ਹੁਣ ਰੈਂਪ ਬਣਾਏ ਗਏ ਹਨ ਤਾਂ ਕਿ ਉਹ ਵੀਲ੍ਹਚੇਅਰ ਦੇ ਥਰੂ ਰੈਂਪ ਦੇ ਉੱਤੇ ਜਾ ਕੇ ਫਸਟ ਫਲੋਰ ਸੈਕੰਡ ਫਲੋਰ ਦੇ ਉੱਤੇ ਜਾ ਸਕਦੇ ਨੇ ਉਹਨਾਂ ਦੀ ਸੁਵਿਧਾ ਦੇ ਲਈ ਹਰ ਇੱਕ ਤਰੀਕੇ ਨਾਲ ਉਹਨਾਂ ਨੂੰ ਮਦਦ ਕੀਤੀ ਜਾਂਦੀ ਹੈ ਉਪਰਾਲੇ ਬਹੁਤ ਸਾਰੇ ਸਰਕਾਰ ਕਰ ਰਹੀ ਹੈ ਮੈਨੂੰ ਲੱਗਦਾ ਵਿੱਤੀ ਸਹਾਇਤਾ ਵੀ ਇਹਨਾਂ ਦੀ ਕੁਝ ਨਾ ਕੁਝ ਕਰਨੀ ਚਾਹੀਦੀ ਹੈ ਤਾਂ ਕਿ ਥੋੜ੍ਹਾ ਜਿਹਾ ਮਾਪੇ ਵਧੀਆ ਫੀਲ ਕਰਨ ਜੋ ਮਤਲਬ ਜਿਨ੍ਹਾਂ ਦੇ ਵਿੱਚ ਐਨਾ ਯੋਗਤਾ ਨਹੀਂ ਹੁੰਦੀ ਕਿ ਉਹ ਪਾਲ ਪੋਸ਼ ਸਕਣ ਅਤੇ ਉਹ ਇਸ ਤੋਂ ਇਲਾਵਾ ਉਹਨਾਂ ਦੇ ਮਾਪਿਆਂ ਨੂੰ ਸਮੇਂ ਸਮੇਂ 'ਤੇ ਸਨਮਾਨਿਤ ਕਰਦਾ ਰਹਿਣਾ ਚਾਹੀਦਾ ਜਦੋਂ ਉਹ ਸਕੂਲ ਦੇ ਵਿੱਚ ਕਦੇ ਨਾ ਕਦੇ ਆਪਣੇ ਆਪ ਨੂੰ ਇੱਕ ਵਧੀਆ ਤਰੀਕੇ ਨਾਲ ਦੂਸਰੇ ਬੱਚਿਆਂ ਤੋਂ ਅੱਗੇ ਲੈ ਕੇ ਆਉਂਦੇ ਹਨ